ਪੰਜਾਬ ਵਿੱਚ ਕਾਰੋਬਾਰਾਂ ਦਾ ਸਾਹਮਣਾ ਕਰਨ ਵਾਲੀਆਂ ਮੁੱਖ ਚੁਣੌਤੀਆਂ ਇਸ ਪ੍ਰਕਾਰ ਹਨ ਕਿ ਪੰਜਾਬ ਵਿੱਚ ਉਦਯੋਗ ਅਤੇ ਵਪਾਰਕ ਸੈਕਟਰ ਦੀ ਵਿਕਾਸ ਦਰ ਚੰਗੀ ਰਹੀ ਹੈ ਪਰ ਅੱਜ ਵੀ ਕਈ ਮੁੱਖ ਚੁਣੌਤੀਆਂ ਹਨ ਜੋ ਕਾਰੋਬਾਰਾਂ 'ਤੇ ਵਾਧੂ 'ਚ ਰੁਕਾਵਟ ਪੈਦਾ ਕਰ ਰਹੀਆਂ ਹਨ ਜਿਵੇਂ ਕਿ ਉਦਯੋਗਿਕ ਢਾਂਚਾ ਅਤੇ ਵੱਧਦੀ ਲਾਗਤ ਉੱਚੀ ਬਿਜਲੀ ਦਰ ਹੋ ਸਕਦੀਆਂ ਹਨ ਪੰਜਾਬ ਚ ਬਿਜਲੀ ਦੀ ਲਾਗਤ ਹੋਰ ਰਾਜਾਂ ਨਾਲੋਂ ਜ਼ਿਆਦਾ ਹੈ ਜਿਸ ਕਰਕੇ ਉਦਯੋਗਾਂ ਦੀ ਉਤਪਾਦਨ ਲਾਗਤ ਵੱਧ ਜਾਂਦੀ ਹੈ ਜ਼ਾਂਸ ਕਰਕੇ ਮੈਨੂੰਫੈਕਚਰਿੰਗ ਅਤੇ ਐਗਰੀ ਬੇਸਡ ਉਦਯੋਗ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਆਧੁਨਿਕ ਉਦਯੋਗਿਕ ਪਾਰਕ ਅਤੇ ਇੰਫਰਾਸਟਰਕਚਰ ਦੀ ਕਮੀ ਆਈ ਟੀ ਮੈਨੂੰਫੈਕਚਰਿੰਗ ਅਤੇ ਲੋਜਿਸਟਿਕ ਸੈਕਟਰ ਲਈ ਆਧੁਨਿਕ ਇੰਫਰਾਸਟਰਕਚਰ ਦੀ ਘਾਟ ਹੈ ਹੋਰ ਰਾਜ ਜਿਵੇਂ ਹਰਿਆਣਾ ਗੁਜਰਾਤ ਅਤੇ ਉੱਤਰ ਪ੍ਰਦੇਸ਼ ਉਦਯੋਗਿਕ ਵਿਕਾਸ ਵਿੱਚ ਪੰਜਾਬ ਤੋਂ ਅੱਗੇ ਹਨ ਨੌਜਵਾਨਾਂ ਦਾ ਪਰਦੇਸੀ ਹੋਣਾ ਵੀ ਇੱਕ ਮੁੱਖ ਕਾਰਨ ਹੈ ਯੁਵਾਵਾਂ ਦੀ ਵਿਦੇਸ਼ ਜਾ ਬੈਠਕ ਜਿਵੇਂ ਕਿ ਕੈਨੇਡਾ ਯੂਕੇ ਆਸਟਰੇਲੀਆ ਪੰਜਾਬ ਦੇ ਤਕਨੀਕੀ ਅਤੇ ਯੋਗ ਨੌਜਵਾਨ ਵਿਦੇਸ਼ਾਂ ਜਾ ਰਹੇ ਹਨ ਜਿਸ ਕਰਕੇ ਕੁਸ਼ਲ ਕਾਮਿਆਂ ਦੀ ਘਾਟ ਪੈ ਰਹੀ ਹੈ ਸਟੋਰ ਟਾਈਪ ਅਤੇ ਨਵੇਂ ਉਦਯੋਗਾਂ ਨੂੰ ਕੁਸ਼ਲ ਲੇਬਰ ਅਤੇ ਆਈ ਟੀ ਪ੍ਰੋਫੈਸ਼ਨਲ ਲੱਭਣ ਵਿੱਚ ਮੁਸ਼ਕਿਲ ਆ ਰਹੀਆਂ ਹਨ ਮਹਿਲਾਵਾਂ ਅਤੇ ਨੌਜਵਾਨ ਲਈ ਕੰਮ ਦੀ ਘਾਟ ਵੀ ਪੈ ਰਹੀ ਹੈ ਕਾਰੋਬਾਰਾਂ ਮਹਿਲਾਵਾਂ ਅਤੇ ਨਵੀਆਂ ਪੀੜ੍ਹੀਆਂ ਲਈ ਠੋਸ ਰੁਜ਼ਗਾਰ ਅਤੇ ਮੌਕੇ ਨਾ ਹੀ ਪੈਦਾ ਕਰ ਰਹੇ ਹਨ ਜਿਸ ਕਰਕੇ ਉਹਨਾਂ ਦੀ ਰੁਚੀ ਘੱਟ ਰਹੀ ਹੈ